ਸਰਕਾਰੀ ਗੈਰ ਮੁਨਾਫ਼ਾ ਸੰਸਥਾਵਾਂ ਸਾਡੇ ਖੇਤਰ ਵਿੱਚ ਬਹੁਤ ਮਦਦ ਕਰ ਰਹੀਆਂ ਹਨ ਜਿਵੇਂ ਕਿ ਸਾਡੇ ਪਿੰਡਾਂ ਵਿੱਚ ਜਿਮ ਖੋਲੇ ਗਏ ਹਨ ਤਾਂ ਕਿ ਜੋ ਨੌਜਵਾਨ ਨੌਜਵਾਨ ਸਾਡੇ ਨਸ਼ਿਆਂ ਵਾਲੇ ਪਾਸੇ ਨਾ ਜਾਣ ਸਰਕਾਰ ਨੇ ਸਾਡੇ ਪਿੰਡਾਂ ਵਿੱਚ ਬਹੁਤ ਕੰਮ ਕਰਵਾਇਆ ਹੈ ਗਰਾਊਂਡਾਂ ਬਣਵਾਈਆਂ ਨੇ ਕ੍ਰਿਕਟ ਗਰਾਊਂਡ ਬਣਵਾਈਆਂ ਅਤੇ ਫੁੱਟਬਾਲ ਗਰਾਊਂਡ ਬਣਵਾਈਆਂ ਉਹਨਾਂ ਦੇ ਵਿੱਚ ਕ੍ਰਿਕਟ ਦਾ ਸਮਾਨ ਆਉਂਦਾ ਆ ਅਤੇ ਫੁੱਟਬਾਲ ਦਾ ਸਮਾਨ ਆਉਂਦਾ ਆ ਅਤੇ ਬਹੁਤ ਸਾਰੇ ਟੂਰਨਾਮੈਂਟ ਕਰਵਾਏ ਜਾਂਦੇ ਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਹੁਤ ਵਧੀਆ ਪ੍ਰਬੰਧ ਕਰਦੇ ਨੇ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਬਹਿਣ ਦਾ ਉਹਦੇ ਵਿਚ ਬਹੁਤ ਨਵੀਆਂ ਨਵੀਆਂ ਖੇਡਾਂ ਕਰਵਾਈਆਂ ਜਾਂਦੀਆਂ ਨੇ ਨਵੇਂ ਨਵੇਂ ਮੈਦਾਨ ਸਾਡੇ ਪਿੰਡਾਂ ਦੇ ਵਿੱਚ ਬਣਾਏ ਗਏ ਨੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਵਾਲੇ ਪਾਸੇ ਨਾ ਜਾਣ ਅਤੇ ਸਾਡੀਆਂ ਖੇਡਾਂ ਨੂੰ ਅੱਗੇ ਲੈ ਕੇ ਜਾਣ